ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਰਨ ਟਰਾਂਸਪੋਰਟ ਪ੍ਰਾਈਵੇਟ ਲਿਮਟਡ ਤੋਂ ਗੱਲ ਕਰਦੇ ਸਰ ਮੈਂ ਨਾ ਕੱਲ੍ਹ ਆਪਣਾ ਸਤਾਰ੍ਹਾਂ ਬਾਰ੍ਹਾਂ ਦੋ ਹਜ਼ਾਰ ਤੇਈ ਨੂੰ ਕੈਬ ਬੁੱਕ ਕਰਵਾਈ ਸੀ ਆਪਣਾ ਪਟਿਆਲੇ ਤੋਂ ਲੁਧਿਆਣੇ ਦੇ ਲਈ ਅਤੇ ਕਿਸੇ ਕਾਰਨ ਕਰਕੇ ਮੈਂ ਉਹ ਜਿਹੜੀ ਕੈਬ ਸੀ ਉਹ ਰੱਦ ਕਰ ਦਿੱਤੀ ਅਤੇ ਉਸ ਕੈਬ ਨੂੰ ਰ ਮਲ ਕਿ ਜਦੋਂ ਮੈਂ ਕੈਬ ਬੁੱਕ ਕਰਵਾਈ ਸੀ ਤਾਂ ਮੈਂ ਨਾ ਪਹਿਲਾਂ ਹੀ ਭੁਗਤਾਨ ਕਰਤਾ ਸੀ ਅਡਵਾਂਸ ਦੇ ਵਿੱਚ ਪਹਿਲੇ ਆਪਣਾ ਪੇਮੈਂਟ ਵਗੈਰਾ ਕਰਤੀ ਸੀ ਹ ਜਾ ਆਪਣਾ ਸੱਤ ਸੌ ਰੁਪਏ ਪੇਮੈਂਟ ਕੀਤੀ ਸੀ ਅਤੇ ਮੈਂ ਆਪਣਾ ਰੱਦ ਕਰਤੀ ਸੀ ਅਤੇ ਇਸ ਕਰਕੇ ਮੈਂ ਹੁਣ ਚਾਹੁੰਦੀ ਸੀ ਕਿ ਕਿਵੇਂ ਮੇਰਾ ਆਪਣਾ ਰਿਫੰਡ ਵਗੈਰਾ ਕਿ ਮੈਂ ਰਿਫੰਡ ਕਰਵਾਉਣਾ ਚਾਹੁੰਦੀ ਹਾਂ ਆਪਣੇ ਪੈਸੇ ਜਿਹੜੇ ਮੈਂ ਪਹਿਲੀਂ ਐਡਵਾਂਸ ਦੇ ਵਿੱਚ ਉਹਨਾਂ ਨੂੰ ਪੇ ਕਰਤੇ ਸੀ ਅਤੇ ਸਰ ਮੈਂ ਇਸ ਕਰਕੇ ਰੱਦ ਕੀਤੀ ਸੀ ਕੈਬ ਕਿਉਂਕਿ ਨਾ ਮੈਂ ਸਵੇਰੇ ਤਾਂ ਜਾਣਾ ਸੀ ਆਪਣਾ ਸਵੇਰੇ ਪੰਜ ਵਜੇ ਤੁਰ ਪੈਣਾ ਸੀ ਇੱਥੋਂ ਪਰ ਨਾ ਸਰ ਮਲ ਕਿ ਥੋੜ੍ਹੀ ਦੇਰ ਪਹਿਲਾਂ ਹੀ ਤਿੰਨ ਕੁ ਵਜੇ ਸਾਡੇ ਘਰ ਫੋਨ ਆਇਆ ਮੇਰੀ ਭੂਆ ਜੀ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੋ ਗਈ ਮਲ ਕਿ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਕਾਫੀ ਜ਼ਿਆਦਾ ਗੰਭੀਰ ਉਹਦੇ 'ਚ ਆ ਗਏ ਸੀ ਗੰਭੀਰ ਹੋ ਗਏ ਸੀ ਇਸ ਕਰਕੇ ਫਿਰ ਰਾਤ ਨੂੰ ਸਾਡੇ ਘਰ ਉਹਨਾਂ ਦਾ ਫੋਨ ਆਇਆ ਇਸ ਕਰਕੇ ਮਲ ਕਿ ਸਾਰੇ ਘਰਦਿਆਂ ਨੂੰ ਜਾਣਾ ਪਿਆ ਉੱਥੇ ਅਤੇ ਉਹਦੇ ਕਰਕੇ ਫਿਰ ਘਰ ਮਲ ਕਿ ਮੇਰਾ ਛੋਟਾ ਭਤੀਜਾ ਸੀ ਉਹ ਦੋ ਸਾਲਾਂ ਦਾ ਸੀ ਤਾਂ ਫਿਰ ਘਰ ਮੈਨੂੰ ਰਹਿਣਾ ਪਿਆ ਮਜ਼ਬੂਰੀ ਕਰਕੇ ਕਿਉਂਕਿ ਸਾਰੇ ਘਰਦੇ ਉੱਥੇ ਚਲ ਗਏ ਸੀ ਭੂਆ ਕੋਲ ਕਿਉਂਕਿ ਕਾਫੀ ਜ਼ਿਆਦਾ ਗੰਭੀਰ ਉਹਨਾਂ ਦੀ ਤਬੀਅਤ ਹੋ ਗਈ ਸੀ ਖਰਾਬ ਹੋ ਗਈ ਸੀ ਇਸ ਕਰਕੇ ਫਿਰ ਮਤਲਬ ਕਿ ਮੈਨੂੰ ਸਵੇਰੇ ਮਲ ਕਿ ਫੋਨ ਕਰਕੇ ਰੱਦ ਕਰਨੀ ਪਈ ਕੈਬ ਅਤੇ ਮੈਂ ਜਦੋਂ ਮਲ ਕਿ ਮੈਂ ਐਡਵਾਂਸ ਪੇ ਕਰਤਾ ਸੀ ਸੱਤ ਸੌ ਰੁਪਏ ਤਾਂ ਮੈਂ ਉਹ ਪੁੱਛਣਾ ਸੀ ਕਿ ਉਹਨੂੰ ਹੁਣ ਮੈਂ ਆਪਣਾ ਵਾਪਸ ਲੈਣਾ ਆ ਕਿ ਮੈ ਐਡਵਾਂਸ 'ਚ ਕਰਤਾ ਸੀ ਨਾ ਇਸ ਕਰਕੇ ਤਾਂ ਫਿਰ ਮੈਂ ਉਹ ਪੁੱਛਣਾ ਸੀ ਕਿ ਸਰ ਤੁਸੀਂ ਇਹ ਮਲ ਕਿ ਮੈਨੂੰ ਕਿਵੇਂ ਵਾਪਸ ਕਰੋਂਗੇ ਰਿਫੰਡ ਕਰੋਂਗੇ ਮੇਰੇ ਪੈਸੇ ਮੈਂ ਗੂਗ ਗੂਗਲ ਪੇ ਵੀ ਕਰਵਾ ਸਕਦੀ ਹਾਂ ਪੇਟੀਐੱਮ ਵੀ ਕਰਵਾ ਸਕਦੀ ਹਾਂ ਅਤੇ ਮੈਂ ਬੈਂਕ ਖਾਤੇ 'ਚ ਪੁਆ ਸਕਦੀ ਹਾਂ ਹੁਣ ਤੁਸੀਂ ਦੱਸ ਦਿਉ ਕਿ ਤੁਹਾਡੀ ਸੁਵਿਧਾ ਦੇ ਅਨੁਸਾਰ ਮਲ ਕਿ ਕਿਸ ਤਰੀਕੇ ਨਾਲ ਕਰੋਂਗੇ ਬਾਕੀ ਸਰ ਮੈਂ ਨੰਬਰ ਵਗੈਰਾ ਸਾਰਾ ਕੁਝ ਉੱਥੇ ਕੰਪ ਦਿੱਤਾ ਹੋਇਆ ਤੁਹਾਡੀ ਕੰਪਨੀ 'ਚ ਸੰਜਨਾ ਸੰਜਨਾ ਰਾਣੀ ਦੇ ਨਾਮ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਕਰਨਾ ਹੋਵੇ ਐਡਵਾਂਸ ਜਿਹੜੀ ਮੈਂ ਪੇਮੈਂਟ ਕੀਤੀ ਹੋਈ ਆ ਅਤੇ ਹਾਂਜੀ ਮੈਂ ਪੇਮੈਂਟ ਹਾਂਜੀ ਤਾਂ ਫਿਰ ਹੁਣ ਸਰ ਮੈਂ ਤੁਹਾਨੂੰ ਨਾ ਆਪਣਾ ਖਾਤਾ ਨੰਬਰ ਉਹ ਕਰ ਦਿੰਦੀ ਹਾਂ ਤੁਹਾਨੂੰ ਭੇਜ ਦਿੰਦੀ ਹਾਂ ਆਪਣਾ ਮੈਸੇਜ ਟੈਕਸਟ ਮੈਸੇਜ ਕਰਕੇ ਸੰਦੇਸ਼ ਭੇਜ ਦਿੰਦੀ ਹਾਂ ਅਤੇ ਤੁਸੀਂ ਉਸ ਅਕਾਊਂਟ ਨੰਬਰ 'ਤੇ ਕਰ ਦਿਉ ਜੀ ਹਾਂਜੀ ਉਸ ਅਕਾਊਂਟ ਨੰਬਰ 'ਤੇ ਜਿਹੜੀ ਮੇਰੀ ਭੁੱਖ ਮਲ ਕਿ ਪੇਮੈਂਟ ਕੀਤੀ ਹੋਈ ਅਡਵਾਂਸ ਪੇਮੈਂਟ ਉਸ 'ਤੇ ਉਸ ਅਕਾਊਂਟ ਨੰਬਰ 'ਤੇ ਤੁਸੀਂ ਪਾ ਸਕਦੇ ਜੀ ਬਾਕੀ ਵਾਪਸ ਬੈਂਕ ਖਾਤੇ ਦੇ ਵਿੱਚ ਧੰਨਵਾਦ ਜੀ